ਜਿਵੇਂ ਕਿ ਤੁਸੀਂ ਪੁੱਛਿਆ ਹੀ ਹੈ ਕਿ ਪੰਜਾਬੀ ਭਾਸ਼ਾ ਦੀਆਂ ਕੁਝ ਵਿਲੱਖਣ ਵਿਸ਼ੇਸ਼ਤਾਵਾਂ ਕੀ ਹਨ ਜੋ ਮੈਨੂੰ ਦਿਲਚਸਪ ਲੱਗਦੀਆਂ ਨੇ ਐਕਚੁਲੀ ਜੋ ਪੰਜਾਬੀ ਲੈਂਗੁਏਜ ਹੈ ਇੱਕ ਤਾਂ ਬੋਲਣ 'ਚ ਬੜੀ ਈਜ਼ੀ ਲੱਗਦੀ ਹੈ ਮੈਨੂੰ ਅਤੇ ਦੂਸਰੀ ਗੱਲ ਇਹ ਹੈ ਕਿ ਬੜੀ ਸੌਖੀ ਲੈਂਗੁਏਜ ਹੈ ਇਹਨੂੰ ਸਿੱਖਣਾ ਬੜਾ ਹੀ ਸੌਖਾ ਹੈ ਠੀਕ ਹੈ ਮੈਂ ਆਈ ਥਿੰਕ ਮੈਂ ਇਹ ਵੀ ਇੱਕ ਟੀਚਰ ਆ ਮੈਂ ਪੰਜਾਬੀ ਲੈਂਗੁਏਜ ਬੱਚਿਆਂ ਨੂੰ ਪੜ੍ਹਾਉਂਦਾ ਤਾਂ ਬੜੇ ਅੱਛੀ ਤਰ੍ਹਾਂ ਬੜੀ ਜਲਦੀ ਪਕੜ ਕਰ ਲੈਂਦਾ ਬਜਾਏ ਕਿ ਜੇ ਮੈਂ ਹਿੰਦੀ ਪੜ੍ਹਾਉਣਾ ਤਾਂ ਉਹ ਹਿੰਦੀ ਨੂੰ ਥੋੜਾ ਟਾਈਮ ਲਗਾਉਂਦਾ ਬੱਚਾ ਪੜ੍ਹਨ ਨੂੰ ਬਟ ਜਿਹੜੀ ਪੰਜਾਬੀ ਲੈਂਗੁਏਜ ਬੋਲਣ ਦੇ ਵਿੱਚ ਵਧੀਆ ਇੱਕ ਹਾਸਾ ਵੀ ਪ੍ਰਗਟ ਕਰਦੀ ਹੈ ਇਹ ਲੈਂਗੁਏਜ ਅਤੇ ਬਾਕੀ ਹੋਰ ਵੀ ਇਹ ਪੰਜਾਬੀ ਲੈਂਗੁਏਜ ਸਾਡੀ ਤੁਹਾਨੂੰ ਹੈ ਪਤਾ ਪੰਜਾਬ ਦੀ ਜਿਹੜੀ ਭਾਰਤ ਦੇ ਵਿੱਚ ਜਿਹੜਾ ਹਿੰਦੂਸਤਾਨ ਦੇ ਵਿੱਚ ਜਿਹੜਾ ਪੰਜਾਬ ਹੈ ਭਾਰਤ ਦੇ ਵਿੱਚ ਹੈ ਉਰੇ ਗੁਰਮੁਖੀ ਲਿਪੀ ਨਾਲ ਵਾਲੀ ਬੋਲੀ ਜਾਂਦੀ ਹੈ ਪਰ ਜਿਹੜਾ ਪਾਕਿਸਤਾਨ 'ਚ ਹੈ ਉੱਥੇ ਜਿਹੜਾ ਪੰਜਾਬ ਹੈ ਉੱਥੇ ਜਿਹੜੀ ਬੋਲੀ ਜਾਂਦੀ ਸ਼ਾਹ ਮੁਖੀ ਕਿਉਂਕਿ ਉਹ ਸਾਡੇ ਇਧਰੋਂ ਹੀ ਡੀ ਤੁਹਾਨੂੰ ਪਤਾ ਹੀ ਹੈ ਕਿ ਉੱਨੀ ਸੌ ਸੰਤਾਲੀ ਦੀ ਵੰਡ ਵਿੱਚ ਪੰਜਾਬ ਦਾ ਐਚੂਲੀ ਬਟਵਾਰਾ ਹੋਇਆ ਸੀ ਤਾਂ ਉੱਥੇ ਵਾਲੀ ਜਿਹੜੀ ਲਿਪੀ ਆ ਉਹ ਸ਼ਾਹ ਮੁਖੀ ਆ ਅਤੇ ਬੋਲਣ ਦੇ ਵਿੱਚੋਂ ਥੋੜ੍ਹਾ ਉਰਦੂ ਦੇ ਨਾਲ ਉਰਦੂ ਵਾਲਾ ਟੱਚ ਦਿੰਦੀ ਆ ਉਹ ਲੈਂਗੁਏਜ ਤਾਂ ਬਸ ਇਹ ਕਿ ਲੈਂਗੁਏਜ ਬਹੁਤ ਵਧੀਆ ਬੋਲਣ ਦੇ ਵਿੱਚ ਦੂਸਰੀ ਗੱਲ ਸਿੱਖਣ ਦੇ ਵਿੱਚ ਵੀ ਬੜੀ ਸੌਖੀ ਹੈ ਬੜੀ ਜਲਦੀ ਬੰਦਾ ਸਿੱਖ ਲੈਂਦਾ ਹੈ ਅਤੇ ਉਰਦੂ ਟੱਚ ਹੈ ਇਸ ਲੈਂਗੁਏਜ ਇਸ ਲੈਂਗੁਏਜ ਕੁਛ ਵਰਡਸ ਅਜਿਹੇ ਆਉਂਦੇ ਜਿਹੜੇ ਉਰਦੂ ਟੱਚ ਦਿੰਦੇ ਨੇ ਕਿਉਂ ਕਿਉਂਕਿ ਉਰੇ ਪਹਿਲਾਂ ਪਾਕਿਸਤਾਨ ਦੇ ਕੁਛ ਏਰੀਏ ਜਿਹੜੇ ਆਪਣੇ ਨਾਲ ਲੱਗਦੇ ਰਹੇ ਨੇ ਹੁਣ ਅੰਮ੍ਰਿਤਸਰ ਦੇ ਨਾਲ ਲਾਹੌਰ ਲੱਗਦਾ ਹੈ ਤਾਂ ਉੱਥੇ ਕੁਛ ਅਜੇ ਵਰਡ ਹੈਗੇ ਨੇ ਜਿਹੜੇ ਮੁਲਤਾਨ ਹੋ ਗਏ ਜਿਵੇਂ ਇੱਥੇ ਕੁਝ ਵਰਡ ਹੈਗੇ ਨੇ ਜੋ ਕਿ ਆਪਾਂ ਨੂੰ ਉਰੇ ਉਰੇ ਦਾ ਜਿਹੜਾ ਦੇਖਣ ਨੂੰ ਪਾਕ ਉਰਦੂ ਦਾ ਟੱਚ ਮਿਲਦਾ ਪੰਜਾਬੀ ਲੈਂਗੁਏਜ ਦੇ ਵਿੱਚ ਠੀਕ ਹੈ ਜੀ